ਸਾਡੇ ਪਿੰਡ ਵਿੱਚ ਲੋਕ ਨਾਚ ਪ੍ਰਸਿੱਧ ਜਿਹੜਾ ਹੈ ਉਹ ਤਾਂ ਭੰਗੜਾ ਔਰ ਗਿੱਧਾ ਹੈ ਲੋਕ ਵੱਖ ਵੱਖ ਸਮੇਂ ਤੋਂ ਇਹਨਾਂ ਦਾ ਅਨੰਦ ਮਾਣਦੇ ਹੈ ਜਿਵੇਂ ਵਿਆਹ ਸ਼ਾਦੀਆਂ ਹੋ ਗਈਆਂ ਕੋਈ ਜਿਵੇਂ ਹੁਣ ਲੋ ਕੁੜੀਆਂ ਤੀਆਂ ਮਨਾਉਣ ਲੱਗ ਗਈਆਂ ਇਕੱਠੀਆਂ ਹੋ ਕੇ ਤਾਂ ਉਹ ਗਿੱਧਾ ਵਗੈਰਾ ਪਾਉਂਦੀਆਂ ਹੈ ਔਰ ਆਸੇ ਪਾਸੇ ਬਹੁਤ ਜ਼ਿਆਦਾ ਸੈਂਟਰ ਖੁੱਲ੍ਹੇ ਵੇ ਜਿਹਦੇ ਨਾਲ਼ ਗਿੱਧਾ ਭੰਗੜਾ ਬੱਚਿਆਂ ਨੂੰ ਸਿਖਾਇਆ ਜਾਂਦਾ ਸਕੂਲਾਂ ਕੋਲਜਾਂ ਵਿੱਚ ਵੀ ਹਰ ਫੰਕਸ਼ਨ ਵਿੱਚ ਬੱਚੇ ਗਿੱਧਾ ਭੰਗੜਾ ਦਾ ਡਾਂਸ ਕਰਦੇ ਹੈ ਔਰ ਬਹੁਤ ਵਧੀਆ ਲੱਗਦਾ ਹੈ ਜਦੋਂ ਆਪਣਾ ਸਾਰੇ ਜਣੇ ਇਕੱਠੇ ਹੋ ਕੇ ਖੁਸ਼ੀ ਮਨਾਉਂਦੇ ਹੈ ਅਤੇ ਗਿੱਧਾ ਭੰਗੜਾ ਦੁਬਾਰਾ ਪਾਇਆ ਜਾਂਦਾ